ਆਨਲਾਈਨ ਸਕੂਲਿੰਗ ਅਤੇ ਕੋਚਿੰਗ ਨੇ ਬੱਚਿਆਂ ਦੇ ਜੀਵਨ ਨੂੰ ਬਹੁਤ ਜਿਆਦਾ ਪ੍ਰਭਾਵਿਤ ਕੀਤਾ ਐ ਇਹਦੇ ਪ੍ਰਭਾਵ ਆਪਾਂ ਦੋ ਢੰਗ ਦੇ ਨਾਲ ਦੇਖ ਸਕਦੇ ਹਾਂ ਨੰਬਰ ਇੱਕ ਇੱਕ ਨੈਗੇਟਿਵ ਪ੍ਰਭਾਵ ਇੱਕ ਇਹਦਾ ਪੌਜ਼ਟਿਵ ਪ੍ਰਭਾਵ ਜਦੋਂ ਆਨਲਾਈਨ ਸਕੂਲਿੰਗ ਦੀ ਆਪਾਂ ਗੱਲ ਕਰਦੇ ਆਂ ਤਾਂ ਬੱਚਿਆਂ ਦਾ ਇੱਕ ਤਾਂ ਜਿਹੜਾ ਜਦੋਂ ਨੈਗਟਿਵ ਪ੍ਰਭਾਵ ਦੀ ਗੱਲ ਕਰਦੇ ਆਂ ਆਪਾਂ ਆਨਲਾਈਨ ਸਕੂਲਿੰਗ ਦੀ ਤਾਂ ਜਿਹੜਾ ਬੱਚਿਆਂ ਦਾ ਟੀਚਰ ਦੇ ਨਾਲ ਜਿਹੜਾ ਇੰਟਰੈਕਸ਼ਨ ਐ ਕਲਾਸ ਇੰਟਰੈਕਸ਼ਨ ਐ ਜਾਂ ਆਈ ਕੰਟੈਕਟ ਆ ਉਹ ਟੁੱਟਦਾ ਐ ਔਰ ਕੋਚਿੰਗ ਦੇ ਨਾਲ ਬੱਚਿਆਂ ਦੇ ਜੀਵਨ ਨੂੰ ਕਿਵੇਂ ਪ੍ਰਭਾਵਿਤ ਕੀਤਾ ਇੱਕ ਤਾਂ ਕੋਚਿੰਗ ਦੇ ਨਾਲ ਬੱਚਿਆਂ ਦਾ ਜਿਹੜਾ ਨੈਗੇਟਿਵ ਪ੍ਰਭਾਵ ਜਦੋਂ ਸਾਨੂੰ ਨਜ਼ਰ ਆਉਂਦਾ ਤਾਂ ਉਹਨਾਂ ਦੇ ਦਿਮਾਗ ਪਰ ਇੱਕ ਕੰਪੀਟੀਸ਼ਨ ਦਾ ਜਿਹੜਾ ਬਟਨ ਸਾਨੂੰ ਨਜ਼ਰ ਆਉਂਦਾ ਕੀ ਕੋਚਿੰਗ ਜਿਹੜੇ ਸੈਂਟਰ ਐ ਉਹ ਬਹੁਤ ਜਿਆਦਾ ਦਿਮਾਗ ਦੇ ਉੱਤੇ ਪ੍ਰਭਾਵ ਪਾ ਦਿੰਦੇ ਬਈ ਯਾਰ ਤੁਸੀਂ ਐਵੇਂ ਨਹੀਂ ਐਵੇਂ ਕਰੋ ਇਨਾ ਤੁਹਾਡਾ ਕੋਂਪੀਟੀਸ਼ਨ ਹੈ ਔਰ ਐਨੇ ਥੋਨੂੰ ਟਫ ਕੋਂਪੀਟੀਸ਼ਨ ਦੇ ਵਿੱਚੋਂ ਨਿਕਲ ਕੇ ਜਿਹੜਾ ਅੱਗੇ ਸਾਹਮਣਾ ਆਉਂਦਾ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋਗੇ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਬੱਚੇ ਸਕੂਲ ਤੋਂ ਆਉਂਦੇ ਜਾਂ ਕਾਲਜ ਤੋਂ ਆਉਂਦੇ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਆਉਂਦੇ ਤਾਂ ਉਹ ਕਿਆ ਖੇਲਣ ਜਾਂਦੇ ਮੌਜ ਮਸਤੀ ਕਰਨ ਜਾਂਦੇ ਪਰ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਦੇ ਦਿਮਾਗ ਤੇ ਐਨਾ ਜਿਆਦਾ ਲੋਡ ਐ ਕਿ ਬੱਚੇ ਆਉਣ ਸਾਰ ਆਪਣਾ ਝੋਲਾ ਸਿੱਟਣ ਤੋਂ ਬਾਅਦ ਟਿਊਸ਼ਨਾਂ ਨੂੰ ਕੋਚਿੰਗ ਸੈਂਟਰਾਂ ਨੂੰ ਵੱਗਦੇ ਤਾਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਪੀਟੇਟਿਵ ਇਗਜ਼ਾਮ ਦੀ ਤਿਆਰੀ ਕਰ ਸਕਣ ਦੂਜੇ ਪਾਸੇ ਆਨਲਾਈਨ ਸਕੂਲਿੰਗ ਦਾ ਜਦੋਂ ਆਪਾਂ ਪੋਜ਼ੀਟਿਵ ਪ੍ਰਭਾਵ ਦੇਖਦੇ ਤਾਂ ਗਰੀਬ ਬੱਚੇ ਜਿਹੜੇ ਸਕੂਲ ਅਫੋਰਡ ਨਹੀਂ ਕਰ ਸਕਦੇ ਜਿਹੜੀ ਯੂਨੀਵਰਸਿਟੀ ਨੂੰ ਅਫੋਰਡ ਨਹੀਂ ਕਰ ਸਕਦੇ ਜਿਹੜੇ ਕਾਲਜ ਨੂੰ ਅਫੋਰਡ ਨਹੀਂ ਕਰ ਸਕਦੇ ਉਹ ਘਰੇ ਬੈਠ ਕੇ ਆਪਣਾ ਜਿਹੜਾ ਕੰਮ ਐ ਉਹ ਕਰ ਸਕਦੇ ਔਰ ਆਨਲਾਈਨ ਸਕੂਲਿੰਗ ਦੇ ਨਾਲ ਬੱਚੇ ਅੱਜ ਆਪਣੇ ਹੱਥ ਦੇ ਵਿੱਚ ਇੱਕ ਮੋਬਾਈਲ ਫੋਨ ਲੈ ਕੇ ਆਪਣੀ ਜਿਹੜੀ ਸਟੱਡੀ ਐ ਉਹਨੂੰ ਕੰਪਲੀਟ ਕਰ ਸਕਦੇ ਸੋ ਦੋਨੋਂ ਤਰ੍ਹਾਂ ਦੇ ਪ੍ਰਭਾਵ ਸਾਨੂੰ ਆਨਲਾਈਨ ਸਕੂਲਿੰਗ ਦੇ ਸਾਨੂੰ ਨਜ਼ਰ ਆਉਂਦੇ ਆ ਜੀ ਨਾਲ ਈ ਨਾਲ ਕੋਚਿੰਗ ਸੈਂਟਰ ਦੇ ਵੀ ਕੋਚਿੰਗ ਸੈਂਟਰ ਨੇ ਜਿੱਥੇ ਬੱਚਿਆਂ ਦੇ ਵਿੱਚ ਕੋਂਪੀਟੀਸ਼ਨ ਦੀ ਪ੍ਰਭਾਵ ਨਾ ਭਾਵਨਾ ਨੂੰ ਵਧਾਇਆ ਉੱਥੇ ਸਟਰੈਸ ਲੈਵਲ ਨੂੰ ਬੱਚਿਆਂ ਦੇ ਉੱਪਰ ਇੱਕ ਥੋਪ ਕੇ ਰੱਖ ਦਿੱਤਾ ਜੋ ਕਿ ਆਣ ਵਾਲੇ ਸਮੇਂ ਵਿੱਚ ਸਹੀ ਨਹੀਂ ਐ